ਹਾਂਜੀ ਮੈਂ ਹਰ ਸੁਬਹ ਜਪੁਜੀ ਸਾਹਿਬ ਦਾ ਪਾਠ ਕਰਦੀ ਹਾਂ ਜਪੁਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਪਹਿਲੀਆਂ ਸਲੋਕ ਤੋਂ ਸ਼ੁਰੂ ਹੁੰਦਾ ਇੱਕ ਓਂਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਇਹਦੇ ਵਿੱਚ ਇੱਕ ਓਂਕਾਰ ਦਾ ਮਤਲਬ ਹੈ ਕਿ ਜੋ ਪਰਮਾਤਮਾ ਹੈ ਉਹ ਇੱਕ ਹੈ ਸਤਿ ਨਾਮੁ ਦਾ ਮਤਲਬ ਹੈ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸੱਚ ਹੈ ਕਰਤਾ ਪੁਰਖੁ ਹੈ ਮਤਲਬ ਜਿਹੜਾ ਵਾਹਿਗੁਰੂ ਪਰਮਾਤਮਾ ਉਹ ਆਪ ਕਰਨਹਾਰ ਹੈ ਸਾਰੀ ਸ੍ਰਿਸ਼ਟੀ ਦਾ ਜਿਹੜਾ ਕਰਨਹਾਰ ਹੈ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਹੈ ਨਿਰਭਉ ਹੈ ਉਹਨੂੰ ਕਿਸੇ ਦਾ ਭਉ ਨਹੀਂ ਹੈ ਨਿਰਵੈਰੁ ਹੈ ਉਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਹੈ ਅਕਾਲ ਮੂਰਤਿ ਹੈ ਉਹਦੀ ਕੋਈ ਮੂਰਤ ਨਹੀਂ ਹੈ ਅਜੂਨੀ ਹੈ ਅਜੂਨਾਂ ਤੋਂ ਰਹਿਤ ਹੈ ਉਹ ਜਿੰਨੀਆਂ ਵੀ ਚੌਰਾਸੀ ਲੱਖ ਜੂਨਾਂ ਹੈ ਉਹ ਚੌਰਾਸੀ ਲੱਖ ਜੂਨਾਂ ਦੇ ਵਿੱਚ ਨਹੀਂ ਆਉਂਦਾ ਸੈਭੰ ਗੁਰ ਪ੍ਰਸਾਦਿ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ